ਹਾਂਜੀ ਸਤਿ ਸ਼੍ਰੀ ਅਕਾਲ ਸਰ ਮੈਂ ਤੁਹਾਡੇ ਟਰਾਂਸਪੋਰਟ ਤੋਂ ਜਿਹੜਾ ਸੀ ਉਹ ਇੱਕ ਕੈਬ ਬੁੱਕ ਕਰਵਾਈ ਸੀ ਮੇਰੇ ਕਜਨ ਦੀ ਮੈਰਿਜ ਸੀਗੀ ਮੈਂ ਆਪਣੇ ਸ਼ਹਿਰ ਤੋਂ ਦੂਰ ਪੰਜਾਹ ਕਿਲੋਮੀਟਰ ਦੂਰ ਦਾ ਜਿਹੜਾ ਸੀ ਉਹ ਸਫਰ ਤੈਅ ਕਰਨਾ ਸੀਗਾ ਅਤੇ ਮੈਂ ਉਹ ਕੈਬ ਬੁੱਕ ਕਰਵਾਈ ਸੀ ਅਤੇ ਜਿਹਦੇ ਨਾਲ ਸੰਬੰਧਿਤ ਕਿਰਾਏ ਬਾਰੇ ਸਾਰੀ ਗੱਲਬਾਤ ਜਿਹੜੀ ਆ ਉਹ ਮੈਂ ਤੁਹਾਡੇ ਨਾਲ ਕਰ ਲਈ ਸੀਗੀ ਠੀਕ ਹੈ ਤੁਸੀਂ ਜਿੰਨਾ ਵੀ ਤੁਹਾਡਾ ਓਨੇ ਦੂਰੀ ਦਾ ਕਿਰਾਇਆ ਬਣਦਾ ਸੀਗਾ ਉਹ ਤੁਸੀਂ ਮੈਨੂੰ ਦੱਸਿਆ ਸੀਗਾ ਅਤੇ ਮੈਂ ਤੁਹਾਨੂੰ ਓਨਾ ਭੁਗਤਾਨ ਕਰਨ ਲਈ ਜਿਹੜਾ ਸੀ ਉਹ ਤਿਆਰ ਸੀਗੀ ਹੁਣ ਅੱਜ ਜਦੋਂ ਮੈਂ ਤੁਹਾਡੀ ਮਤਲਬ ਇਹ ਟੈਕਸੀ ਲੈ ਕੇ ਕੈਬ ਲੈ ਕੇ ਆਪਣੇ ਜਾ ਰਹੀ ਹਾਂ ਰਿਸ਼ਤੇਦਾਰਾਂ ਦੇ ਕੋਲ ਅਤੇ ਜਿਹੜਾ ਡਰਾਈਵਰ ਤੁਸੀਂ ਭੇਜਿਆ ਹੈਗਾ ਵਾ ਉਹ ਮੇਰੇ ਕੋਲੋਂ ਜਿਹੜਾ ਵਾ ਉਹ ਜ਼ਿਆਦਾ ਕਿਰਾਏ ਦੀ ਜਿਹੜੀ ਆ ਉਹ ਮੰਗ ਕਰ ਰਿਹਾ ਵਾ ਅਤੇ ਇਸ ਲਈ ਮੈਂ ਹੁਣ ਜਿੰਨਾ ਤੁਸੀਂ ਦੱਸਿਆ ਸੀ ਉਸ ਹਿਸਾਬ ਨਾਲ ਆਪਣਾ ਪੂਰਾ ਬਜਟ ਜਿਹੜਾ ਵਾ ਉਹ ਤਿਆਰ ਕਰਕੇ ਹੀ ਪ੍ਰੋਗਰਾਮ ਲਈ ਆਈ ਸੀ ਅਤੇ ਮੇਰੇ ਕੋਲ ਵੱਧ ਪੈਸੇ ਦੇਣ ਲਈ ਹੈ ਨਹੀਂ ਹੈ ਇਸ ਵਕਤ ਤਾਂ ਦੂਸਰੀ ਗੱਲ ਜਦੋਂ ਆਪਣੀ ਗੱਲ ਪਹਿਲਾਂ ਹੀ ਹੋ ਚੁੱਕੀ ਸੀ ਕਿ ਮੈਂ ਤੁਹਾਨੂੰ ਇੰਨਾ ਕਿਰਾਇਆ ਭੁਗਤਾਨ ਕਰਾਂਗੀ ਜਾਂ ਤੁਸੀਂ ਤਾਂ ਦੱਸਿਆ ਕਿ ਤੁਹਾਡਾ ਇੰਨਾ ਬਣਦਾ ਵਾ ਅਤੇ ਮੈਂ ਦੇਣ ਲਈ ਤਿਆਰ ਸੀ ਅਤੇ ਇਹ ਸਾਰੀ ਗੱਲਬਾਤ ਪੱਕੀ ਹੋਣ ਤੋਂ ਬਾਅਦ ਕਿਰਾਏ ਦਾ ਵਧਣਾ ਜਾਂ ਘਟਣਾ ਤਾਂ ਸਹੀ ਨਹੀਂ ਹੈਗਾ ਅਤੇ ਮੈਂ ਤੁਹਾਨੂੰ ਮਤਲਬ ਇਹ ਹੁਣ ਡਰਾਈਵਰ ਦੀ ਜਿਹੜੀ ਕੈਬ ਦਾ ਡਰਾਈਵਰ ਹੈ ਉਹਦੀ ਸ਼ਿਕਾਇਤ ਹੀ ਕਰਦੀ ਪਈ ਹਾਂ ਕਿ ਤੁਸੀਂ ਇਹਦੇ ਵੱਲ ਥੋੜ੍ਹਾ ਧਿਆਨ ਦਿਓ ਇਹਦੇ ਨਾਲ ਤੁਹਾਡੀ ਵੀ ਇੱਕ ਬਣੀ ਬਣਾਈ ਸਮਾਜ ਵਿੱਚ ਜਿਹੜੀ ਇੱਜ਼ਤ ਹੈ ਉਹ ਖਰਾਬ ਹੁੰਦੀ ਆ ਅਤੇ ਜਿਹੜਾ ਸਵਾਰੀ ਹੈਗੀ ਆ ਜਿਹਨੇ ਸਵਾ ਸਫਰ ਕਰਨਾ ਵਾਂ ਉਹਨੂੰ ਵੀ ਜਿਹੜਾ ਵਾ ਉਹ ਮੁਸ਼ਕਲ ਦਾ ਜਿਹੜਾ ਵਾ ਉਹ ਸਾਹਮਣਾ ਆਉਂਦਾ ਵਾ ਮੈਂ ਤੁਹਾਡੇ ਡਰਾਈਵਰ ਨੂੰ ਭੁਗਤਾਨ ਕਰਨ ਤੋਂ ਵਾਧੂ ਭੁਗਤਾਨ ਕਰਨ ਤੋਂ ਸਿੱਧਾ ਇਨਕਾਰ ਕਰ ਦਿੱਤਾ ਵਾ ਅਤੇ ਜੇ ਅੱਜ ਇਹ ਚੀਜ਼ ਦਾ ਸਾਹਮਣਾ ਮੈਨੂੰ ਕਰਨਾ ਪਿਆ ਵਾ ਤਾਂ ਤੁਹਾਡੇ ਵੱਲੋਂ ਇਹਨਾਂ ਨੂੰ ਹੋਰ ਵੀ ਬਹੁਤ ਥਾਵਾਂ 'ਤੇ ਭੇਜਿਆ ਜਾਂਦਾ ਹੋਊਗਾ ਅਤੇ ਇਹ ਉਹਨਾਂ ਨਾਲ ਵੀ ਕੁਝ ਇੱਦਾਂ ਦਾ ਵਿਵਹਾਰ ਕਰਦੇ ਹੋਣਗੇ ਜਿਹਦਾ ਕਰਕੇ ਸਾਹਮਣੇ ਵਾਲੇ ਨੂੰ ਬਹੁਤ ਮੁਸ਼ਕਲ ਜਿਹੜੀ ਆ ਆਉਂਦੀ ਹੋਊਗੀ ਅਤੇ ਮੈਂ ਚਾਹੁੰਦੀ ਹਾਂ ਕਿ ਤੁਸੀਂ ਇਹਦੇ 'ਤੇ ਮਤਲਬ ਥੋੜ੍ਹੀ ਕਾਰਵਾਈ ਕਰੋ ਅਤੇ ਇਹਦੇ ਕੰਮ ਕਾਜ ਵੱਲ ਧਿਆਨ ਦਿਓ ਤਾਂ ਕਿ ਤੁਹਾਡੇ ਵੀ ਸਮਾਜ ਵਿੱਚ ਰੁਤਬਾ ਬਰਕਰਾਰ ਰਹੇ ਅਤੇ ਤੁਹਾਡੀ ਏਜੰਸੀ ਦੁਆਰਾ ਏਜੰਸੀ ਦੀਆਂ ਜਿੰਨੀਆਂ ਵੀ ਕੈਬ ਆ ਉਹਨਾਂ ਵਿੱਚ ਸਫਰ ਕਰਨ ਵਾਲੀ ਸਵਾਰੀ ਨੂੰ ਕੋਈ ਵੀ ਜਿਹੜੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਧੰਨਵਾਦ